ਸਤਿ ਸ਼੍ਰੀ ਅਕਾਲ ਜੀ ਜੀ ਮੈਂ ਬਰਨਾਲਾ ਤੋਂ ਕਰਮਨ ਸਿੰਘ ਬੋਲ ਰਿਹਾ ਮੈਂ ਤੁਹਾਡੇ ਬਾਰੇ ਸੁਣਿਆ ਸੀ ਕਿ ਤੁਸੀਂ ਬਹੁਤ ਵਧੀਆ ਮਿਹਨਤੀ ਕਿਸਾਨ ਹੋ ਕੀ ਸਰ ਮੈਨੂੰ ਦੱਸ ਸਕਦੇ ਹੋ ਕੀ ਹੈ ਨਾ ਫ਼ਸਲਾਂ ਬਾਰੇ ਗਰਮੀ ਅਤੇ ਸਰਦੀ ਦੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਜਿਹੜੀਆਂ ਆਪਣੀਆਂ ਗਰਮੀ ਦੀਆਂ ਫ਼ਸਲਾਂ ਹੁੰਦੀਆਂ ਜੀ ਇਹਨਾਂ ਦਾ ਕੀ ਲਾਭ ਹੁੰਦਾ ਜੀ ਆਪਾਂ ਨੂੰ ਹਾਂਜੀ ਹਾਂਜੀ ਜੀ ਹਾਂਜੀ

ਹਾਂਜੀ ਜਿਵੇਂ ਮੈਂ ਸੁਣਿਆ ਸੀ ਤੁਹਾਡੇ ਬਾਰੇ ਤੁਸੀਂ ਬਹੁਤ ਹੀ ਮਿਹਨਤੀ ਅਤੇ ਕਾਮਯਾਬ ਹੈ ਅਤੇ ਤੁਸੀਂ ਉਹੀ ਹੋ ਤਾਂ ਮੈਂ ਬਹੁਤ ਜਣਿਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਸੀ ਜੋ ਮੈਨੂੰ ਨਹੀਂ ਮਿਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਠੀਕ ਧੰਨਵਾਦ